ਇਹ ਗੱਲ ਬਿਲਕੁਲ ਸਹੀ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਸਾਨੂੰ ਆਪਣੀ ਰੋਜ਼ਾਨਾ ਦੀ ਦੌੜ ਭੱਜ ਵਾਲੀ ਜ਼ਿੰਦਗੀ 'ਚੋਂ ਕਸਰਤ ਲਈ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਜੇਕਰ ਅਸੀਂ ਕੁਝ ਸਮਾਂ ਆਪਣੀ ਸਰੀਰਿਕ ਕਸਰਤ ਲਈ ਨਹੀਂ ਕੱਢਦੇ ਤਾਂ ਅਸੀਂ ਸਹਿਜੇ ਹੀ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਚ ਸਕਦੇ ਹਾਂ ਅੱਜ ਅਸੀਂ ਦੇਖਦੇ ਹਾਂ ਕਿ ਮਨੁੱਖ ਧਨ ਦੌਲਤ ਪਦਾਰਥ ਇਕੱਠੇ ਕਰਨ ਦੀ ਦੌੜ ਵਿੱਚ ਦਿਨ ਰਾਤ ਲੱਗਾ ਹੋਇਆ ਹੈ ਉਸ ਕੋਲ ਆਪਣੇ ਸਰੀਰ ਲਈ ਬਿਲਕੁਲ ਵੀ ਸਮਾਂ ਨਹੀਂ ਹੈ ਜਿਸ ਕਾਰਨ ਉਹ ਬਹੁਤ ਸਾਰੀਆਂ ਸਰੀਰਿਕ ਅਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਲ ਸਰੀਰ ਲਈ ਕੁਝ ਸਮਾਂ ਜ਼ਰੂਰ ਕੱਢੇ ਕਸਰਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਜਿਵੇਂ ਕਿ ਯੋਗਾ ਪ੍ਰਾਣਾਯਾਮ ਸੈਰ ਦੌੜਨਾ ਜਿਮ ਕੁਝ ਖੇਡਾਂ ਦੇ ਵਿੱਚ ਭਾਗ ਲੈਣਾ ਆਦਿ ਇਨ੍ਹਾਂ ਵਿੱਚੋਂ ਤੁਹਾਨੂੰ ਜੋ ਵੀ ਚੰਗਾ ਲੱਗਦਾ ਹੈ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਅਪਣਾ ਸਕਦੇ ਹੋ ਮੈਨੂੰ ਕਸਰਤ ਦੇ ਇਨ੍ਹਾਂ ਤਰੀਕਿਆਂ 'ਚੋਂ ਯੋਗਾ ਅਤੇ ਸੈਰ ਕਰਨਾ ਬਹੁਤ ਵਧੀਆ ਲੱਗਦਾ ਹੈ ਯੋਗਾ ਅਤੇ ਸੈਰ ਮੇਰੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਵਿੱਚ ਮੇਰੀ ਸਹਾਇਤਾ ਕਰਦੇ ਹਨ ਮੈਂ ਹਰ ਰੋਜ਼ ਬਿਨ੍ਹ ਨਾਗਾ ਸਵੇਰ ਵੇਲੇ ਯੋਗਾ ਕਰਦਾ ਹਾਂ ਇਸ ਦੇ ਲਈ ਮੈਂ ਆਪਣੇ ਘਰੇਲੂ ਬਗ਼ੀਚੇ ਵਿੱਚ ਯੋਗ ਕਰਦਾ ਹਾਂ ਯੋਗ ਜਿੱਥੇ ਸਾਨੂੰ ਸਰੀਰਕ ਤੌਰ 'ਤੇ ਤੰਦਰੁਸਤ ਬਣਾਉਂਦਾ ਹੈ ਉੱਥੇ ਹੀ ਸਾਨੂੰ ਮਾਨਸਿਕ ਰੂਪ ਤੋਂ ਵੀ ਮਜ਼ਬੂਤ ਬਣਾਉਂਦਾ ਹੈ ਯੋਗਾ ਸਾਡੇ ਸਰੀਰ ਨੂੰ ਤਾਜ਼ੀ ਹਵਾ ਮਿਲਦੀ ਹੈ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਖੂਨ ਸਾਫ਼ ਹੁੰਦਾ ਹੈ ਖਾਦਾ ਪੀਤਾ ਹਜ਼ਮ ਹੁੰਦਾ ਹੈ ਅਤੇ ਆਤਮਾ ਦਾ ਧਿਆਨ ਪਰਮਾਤਮਾ ਦੇ ਨਾਲ ਜੁੜਦਾ ਹੈ ਇਸ ਤੋਂ ਇਲਾਵਾ ਮੈਨੂੰ ਜਦੋਂ ਵੀ ਸਮਾਂ ਮਿਲਦਾ ਹੈ ਮੈਂ ਆਪਣੇ ਮਿੱਤਰਾਂ ਜਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੈਰ ਕਰਨ ਜ਼ਰੂਰ ਜਾਂਦਾ ਹਾਂ ਸੈਰ ਕਰਨ ਦੇ ਵੀ ਬਹੁਤ ਸਾਰੇ ਲਾਭ ਹਨ ਇਸ ਨਾਲ ਅਸੀਂ ਆਪਣਾ ਸਮਾਂ ਚੰਗੀ ਸੰਗਤ ਦੇ ਵਿੱਚ ਬਤੀਤ ਕਰ ਸਕਦੇ ਹਾਂ ਅਤੇ ਸਾਨੂੰ ਸਰੀਰਿਕ ਮਾਨਸਿਕ ਅਤੇ ਹੋਰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਸੈਰ ਜਦੋਂ ਵੀ ਸਮਾਂ ਮਿਲੇ ਕੀਤੀ ਜਾ ਸਕਦੀ ਹੈ ਪਰ ਸਭ ਤੋਂ ਵੱਧ ਫ਼ਾਇਦਾ ਸਵੇਰ ਦੀ ਸੈਰ ਦਾ ਹੀ ਹੈ ਕਿਉਂਕਿ ਉਸ ਸਮੇਂ ਜੋ ਬਾਹਰ ਹਵਾ ਹੁੰਦੀ ਹੈ ਉਹ ਤਾਜ਼ੀ ਹਵਾ ਸਾਡੇ ਸਰੀਰ ਨੂੰ ਮਿਲਦੀ ਹੈ ਅਤੇ ਚੰਗੀ ਆਕਸੀਜਨ ਸਾਡੇ ਸਰੀਰ ਦੇ ਵਿੱਚ ਜਾਂਦੀ ਹੈ ਸੋ ਇਹ ਕੁਝ ਫ਼ਾਇਦੇ ਹਨ ਯੋਗਾ ਅਤੇ ਸੈਰ ਦੇ